ਚੌਵੀ ਅਕਤੂਬਰ ਉੱਨੀ ਸੌ ਅਠਾਸੀ ਗਿਆਰਾਂ ਨਵੰਬਰ ਦੋ ਹਜ਼ਾਰ ਇੱਕੀ ਅਠਾਰਾਂ ਜੂਨ ਦੋ ਹਜ਼ਾਰ ਪੰਦਰਾਂ ਅੱਠ ਜੁਲਾਈ ਦੋ ਹਜ਼ਾਰ ਵੀਹ ਪੰਜ ਜਨਵਰੀ ਦੋ ਹਜ਼ਾਰ ਸੌਲਾਂ